ਮੈਂ ਜੀ ਯੂਟੀਊਬ 'ਤੇ ਇੱਕ ਰੈਸਪੀ ਦੇਖ ਰਹੀ ਸੀਗੀ ਉਹ ਰੈਸਪੀ ਨੂੰ ਦੇਖ ਕੇ ਮੈਂ ਰੈਸਪੀ ਤਿਆਰ ਕਰ ਰਹੀ ਸੀ ਬੱਚੇ ਕਹਿ ਰਹੇ ਸੀ ਮੰਮਾ ਅੱਜ ਕੁਛ ਬਣਾ ਕੇ ਦਿਓ ਅਤੇ ਮੈਂ ਉਹਨਾਂ ਨੂੰ ਦੇਖ ਕੇ ਮੈਂ ਅੱਜ ਰੈਸਪੀ ਤਿਆਰ ਕਰ ਰਹੀ ਸੀਗੀ ਯੂਟੀਊਬ ਤੋਂ ਰੈਸਪੀ ਬੜੀ ਵਧੀਆ ਸੀਗੀ ਉਹ ਸੀਗੀ ਸੋਇਆਬੀਨ ਦੀਆਂ ਬੜੀਆਂ ਦੀ ਰੈਸਪੀ ਸੀਗੀ ਉਹਨੂੰ ਰੈਸਪੀ ਨੂੰ ਦੇਖ ਕੇ ਮੈਂ ਕਿਹਾ ਚਲੋ ਮੈਂ ਅੱਜ ਟਰਾਈ ਕਰਦੀ ਹਾਂ ਰੈਸਪੀ ਬਣਾਉਂਦੀ ਹਾਂ ਮੈਂ ਉਹਨਾਂ ਨੂੰ ਰੈਸਪੀ ਬਣਾਈ ਰੈਸਪੀ ਬੜੀ ਅੱਛੀ ਬਣੀ ਬਸ ਕੁਛ ਮੈਂ ਉਸ ਰੈਸਪੀ ਨੂੰ ਦੇਖ ਕੇ ਆਪਣੇ ਅਨੁਸਾਰ ਸਵਾਦ ਅਨੁਸਾਰ ਨਮਕ ਮਿਰਚ ਚੇਂਜ ਕਰਤਾ ਥੋੜ੍ਹੇ ਜਿਹੇ ਮਸਾਲੇ ਮੇਰੇ ਕੋਲ ਘਰ ਨਹੀਂ ਸੀਗੇ ਜੋ ਸੀਗੇ ਮੈਂ ਉਹਨਾਂ ਨੂੰ ਪਾ ਕੇ ਉਸ ਰੈਸਪੀ ਨੂੰ ਤਿਆਰ ਕੀਤਾ ਰੈਸਪੀ ਬੜੀ ਅੱਛੀ ਬਣੀ ਬੜੀ ਸਵਾਦ ਬਣੀ ਬੱਚਿਆਂ ਨੂੰ ਖਾ ਕੇ ਬੜਾ ਮਜ਼ਾ ਆਇਆ ਰੈਸਪੀ ਬੱਚੇ ਕਹਿੰਦੇ ਮੰਮਾ ਬੜੀ ਅੱਛੀ ਰੈਸਪੀ ਬਣੀ ਹੈ ਪਰ ਮੈਂ ਜੋ ਵੀ ਆਪਣੇ ਘਰ ਵਿੱਚ ਵੀ ਜੋ ਵੀ ਬਣਾਉਂਦੀ ਐ ਬੜਾ ਵਧੀਆ ਬਣਦਾ ਖਾਣਾ ਅਤੇ ਵੀ ਮੈਂ ਆਪਣੇ ਘਰ ਵਿੱਚ ਜਿਵੇਂ ਰਾਤੀ ਦਾਲ ਬਣਾਈ ਮੈਂ ਦਾਲ ਵਿੱਚ ਮਿਰਚ ਘੱਟ ਪਾਈ ਲਸਣ ਘੱਟ ਪਾਇਆ ਬੱਚੇ ਕਹਿ ਰਹੇ ਸੀ ਮੰਮਾ ਤੁਸੀਂ ਮਿਰਚ ਦਾਲ ਵਿੱਚ ਘੱਟ ਪਾਈ ਹੈ ਡਾਕਟਰ ਐਚਲੀ ਰੋਜ਼ਾਨਾ ਹੀ ਦੱਸਦੇ ਨੇ ਵੀ ਆਪਾਂ ਨੂੰ ਮਿਰਚ ਘੱਟ ਖਾਣੀ ਚਾਹੀਦੀ ਹੈ ਮੈਂ ਦਾਲ ਨੂੰ ਤੜਕਾ ਲਾਇਆ ਮਿਰਚ ਘੱਟ ਪਾਈ ਫੁਲਕੇ ਬਣਾਏ ਬੱਚਿਆਂ ਨੂੰ ਟੇਸਟੀ ਲੱਗਿਆ ਬੱਚੇ ਵੀ ਖੁਸ਼ ਹੋ ਕੇ ਖਾ ਲੈਂਦੇ ਜਦੋਂ ਮਿਰਚ ਘੱਟ ਹੋਵੇ ਖਾਣਾ ਸਾਰਾ ਇਸ ਕਰਕੇ ਵੀ ਆਪਾਂ ਨੂੰ ਖਾਣੇ ਵਿੱਚ ਮਿਰਚ ਘੱਟ ਹੀ ਪਾਉਣੀ ਚਾਹੀਦੇ ਆ ਬਾਕੀ ਰੈਸਪੀ ਯੂਟੀਊਬ ਤੋਂ ਦੇਖ ਕੇ ਜੋ ਵੀ ਆਪਣੇ ਕੋਲ ਅਵੇਲੇਬਲ ਹੁੰਦਾ ਸਮਾਨ ਉਹ ਆਪਾਂ ਪਾ ਸਕਦੇ ਹਾਂ ਆਪਣੇ ਸਵਾਦ ਅਨੁਸਾਰ ਚੇਂਜ ਵੀ ਕਰ ਸਕਦੇ ਹਾਂ ਦਾਲ ਰੋਟੀ ਆਮ ਤੌਰ 'ਤੇ ਆਪਾਂ ਰੋਜ਼ਾਨਾ ਘਰ ਬਣਾਉਂਦੇ ਹਾਂ ਉਹਦੇ ਵਿੱਚ ਮਿਰਚ ਮੈਂ ਘੱਟ ਹੀ ਪਾਉਂਦੀ ਹਾਂ ਅਤੇ ਚਪਾਤੀ ਮੇਰੀਆਂ ਛੋਟੀਆਂ ਛੋਟੀਆਂ ਹੁੰਦੀਆਂ ਨੇ ਅਤੇ ਬੱਚਿਆਂ ਨੂੰ ਬੜੀਆਂ ਟੇਸਟੀ ਲੱਗਦੀਆਂ ਨੇ